ਹੈਲੋ ਹਾਂਜੀ ਜੀ ਮੋਲ 'ਚੋਂ ਬੋਲ ਰਹੇ ਹੋ ਜੀ ਹਾਂਜੀ ਅਸੀਂ ਕੱਲ੍ਹ ਨਾ ਬੁਕਿੰਗ ਕਰਵਾਈ ਸੀ ਪਹਿਲਾਂ ਤਾਂ ਬੜੀ ਮੁਸ਼ਕਿਲ ਨਾਲ ਬੁਕਿੰਗ ਹੋਈ ਆ ਆਨਲਾਈਨ ਅਸੀਂ ਬੁਕਿੰਗ ਕਰਵਾਈ ਸੀ ਫਿਲਮ ਦੇਖਣ ਲਈ ਫਿਲਮਾਂ ਤਾਂ ਬਹੁਤ ਲੱਗੀਆਂ ਸੀ ਪਰ ਸਾਨੂੰ ਪਸੰਦ ਆਈ ਸੀ ਮਿੱਤਰਾਂ ਦਾ ਚੱਲਿਆ ਟਰੱਕ ਨੀ ਅਸੀਂ ਚਾਰ ਵਾਲਾ ਸ਼ੋ ਬੁੱਕ ਕਰਵਾਇਆ ਸੀ ਬਟ ਹੁਣ ਸਾਨੂੰ ਕਿਤੇ ਐਮਰਜੈਂਸੀ ਪੈ ਗਈ ਅਸੀਂ ਜਾਣਾ ਗਾ ਜਿਸ ਕਾਰਨ ਅਸੀਂ ਫਿਲਮ ਦੇਖਣ ਨਹੀਂ ਆ ਸਕਦੇ ਫਿਲਮ ਤਾਂ ਅਸੀਂ ਦੇਖਣੀ ਆ ਦਿਲ ਬਹੁਤ ਕਰ ਰਿਹਾ ਮੇਰੇ ਬੱਚੇ ਵੀ ਬਹੁਤ ਜਿੱਦ ਕਰ ਰਹੇ ਸੀ ਕਿੰਨੇ ਦਿਨਾਂ ਲਈ ਵੀ ਅਸੀਂ ਫਿਲਮ ਦੇਖਣੀ ਆ ਮੰਮੀ ਫਿਲਮ ਦੇਖਣੀ ਆ ਬੁਕਿੰਗ ਕਰਵਾ ਲਓ ਅਸੀਂ ਬੁਕਿੰਗ ਕਰਵਾ ਲਈ ਵੀ ਚਲੋ ਫ੍ਰੀ ਟਾਈਮ ਅਸੀਂ ਦੇਖ ਆਨੇ ਹਾਂ ਬਟ ਹੁਣ ਐਮਰਜੈਂਸੀ ਐਸੀ ਆ ਗਈ ਕਿ ਸ ਅਸੀਂ ਹੁਣ ਦੇਖਣ ਨਹੀਂ ਆ ਸਕਦੇ ਸਾਨੂੰ ਜ ਜਾਣਾ ਵੀ ਜ਼ਰੂਰੀ ਆ ਬਾਹਰ ਹੀ ਜਾਣਾਗਾ ਹੋ ਸਕਦਾ ਦੋ ਦਿਨ ਲੱਗ ਜਾਣ ਅਸੀਂ ਦੋ ਦਿਨਾਂ ਬਾਅਦ ਆ ਕੇ ਦੁਬਾਰਾ ਬੁੱਕ ਕਰਵਾ ਲਵਾਂਗੇ ਆਏਂ ਆ ਵੀ ਫਿਲਮ ਸੋਹਣੀ ਆ ਦੇਖਣੀ ਜ਼ਰੂਰੀ ਆ ਕਿਉਂਕਿ ਬੱਚਿਆਂ ਦਾ ਮਨ ਆ ਅਸੀਂ ਇਹਨਾਂ ਨੂੰ ਨਿਰਾਸ਼ ਵੀ ਨਹੀਂ ਕਰ ਸਕਦੇ ਅਤੇ ਅਸੀਂ ਇਸ ਲਈ ਬੁਕਿੰਗ ਰੱਦ ਕਰਵਾਉਣੀ ਹੈ ਸਾਡਾ ਬੁਕਿੰਗ ਨੰਬਰ ਹੈਗਾ ਪੰਜ ਚਾਰ ਤਿੰਨ ਛੇ ਦੋ ਇੱਕ ਅਤੇ ਤੁਸੀਂ ਹੋ ਸਕਿਆ ਤਾਂ ਸਾਡੀ ਬੁਕਿੰਗ ਹੈ ਜੋ ਰੱਦ ਕਰ ਦਿਓ ਤਾਂ ਕਿ ਅਸੀਂ ਵੀ ਸ ਥੋੜ੍ਹੇ ਜਿਹੇ ਸਾਨੂੰ ਪੈਸੇ ਜੋ ਆਨਲਾਈਨ ਵਾਪਸ ਆ ਸਕਣ ਤਾਂ ਕਿ ਅਸੀਂ ਸਾਡਾ ਵੇ ਪੈਸੇ ਵੇਸਟ ਨਾ ਹੋਣ ਅਤੇ ਅਸੀਂ ਹੋ ਸਕਦਾ ਚਾਰ ਪੰਜ ਦਿਨਾਂ ਤੱਕ ਵਾਪਸ ਆ ਜਾਵਾਂਗੇ ਅਤੇ ਅਸੀਂ ਦੇਖ ਲਵਾਂਗੇ ਮੂਵੀ ਕਿਉਂਕਿ ਬੱਚਿਆਂ ਦਾ ਬੜੇ ਦਾ ਬੜਾ ਹੀ ਮਨ ਆ ਮੂਵੀ ਦੇਖਣ ਦਾ ਮੇਰਾ ਵੀ ਦਿਲ ਕਰ ਰਿਹਾ ਵੀ ਅਸੀਂ ਦੇਖ ਕੇ ਆਈਏ ਇੱਕ ਤਾਂ ਮੌਲ ਵੀ ਦੇਖ ਲਵਾਂਗੇ ਨਾਲ ਨਾਲ ਮੋਲ ਸੋਹਣਾ ਗਾ ਤੁਹਾਡਾ ਬਹੁਤ ਵਧੀਆ ਇਸ ਲਈ ਬੁਕਿੰਗ ਦੀ ਵੀ ਥੋੜ੍ਹੀ ਦਿੱਕਤ ਨਾ ਆਵੇ ਇਸ ਲਈ ਅਸੀਂ ਐਡਵਾਂਸ 'ਚ ਹੀ ਫਿਰ ਕਰਵਾ ਲਵਾਂਗੇ ਦੁਬਾਰਾ ਪਰ ਅੱਜ ਲਈ ਸਾਨੂੰ ਜ਼ਰੂਰ ਇਹ ਕਰਿਓ ਵੀ ਸਾਡੀ ਬੁਕਿੰਗ ਆ ਜੋ ਰੱਦ ਹੋ ਸਕੇ ਤਾਂ ਕਿ ਸਾਡੇ ਪੈਸੇ ਸਾਨੂੰ ਵਾਪਸ ਮਿਲ ਸਕਣ ਅਤੇ ਤੁਹਾਡਾ ਧੰਨਵਾਦ ਹੋਵੇਗਾ ਸਾਡੀ ਬੁਕਿੰਗ ਪਲੀਜ਼ ਰੱਦ ਕਰ ਦਿੱਤੀ ਜਾਵੇ